ਹਾਂਜੀ ਜਿਸ ਤਰ੍ਹਾਂ ਸਾਡੇ ਫੋਨ ਵਿੱਚ ਸਭ ਬਹੁਤ ਸਾਰੀਆਂ ਐਪਾਂ ਨੇ ਜੋਨੋ ਫੋਨਪੇ ਗੂਗਲ ਪੇ ਵਟਸਐਪ ਫੇਸਬੁੱਕ ਇੰਸਟਾਗ੍ਰਾਮ ਪਲੇਅ ਸਟੋਰ ਆ ਯੂਟਿਊਬ ਆ ਸ਼ੇਅਰਚੈਟ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਨੇ ਐਪਾਂ ਜਿਹੜੀਆਂ ਸਾਡੇ ਫੋਨ 'ਤੇ ਚੱਲਦੀਆਂ ਪਈਆਂ ਨੇ ਸਮਾਰਟ ਫੋਨ 'ਤੇ ਹੋਰ ਇਸਦੇ ਫਾਇਦੇ ਵੀ ਬਹੁਤ ਨੇ ਫੋਨ ਸਮਾਰਟ ਫੋਨ ਹੋਣ ਦੇ ਜਿਸ ਤਰ੍ਹਾਂ ਕਿ ਹੁਣ ਅਸੀਂ ਘਰ ਬੈਠੇ ਹੀ ਸਕੂਲ ਦੀ ਸਟੱਡੀ ਜਿਹੜੀ ਬੱਚੇ ਹੈ ਘਰ ਬੈਠੇ ਵੀ ਕਰ ਸਕਦੇ ਨੇ ਜਾਂ ਕੋਈ ਅਸੀਂ ਵੀ ਕੋਈ ਕੁਕਿੰਗ ਬਾਰੇ ਜਾਂ ਕੋਈ ਸਟੀਚਿੰਗ ਕਰਨਾ ਹੋਵੇ ਕੋਈ ਸਿਲਾਈ ਕਢਾਈ ਕੁਛ ਵੀ ਅਸੀਂ ਫੋਨ ਤੋਂ ਸਮਾਰਟ ਫੋਨ ਤੋਂ ਅਸੀਂ ਵੇਖ ਸਕਦੇ ਹਾਂ ਬਹੁਤ ਸਾਰੇ ਫ਼ਾਇਦੇ ਨੇ ਇਸ ਤਰ੍ਹਾਂ ਅਤੇ ਫੋਨ ਫੂਨ ਪੇ ਕਰਨਾ ਹੋਵੇ ਤਾਂ ਅਸੀਂ ਬਾਜ਼ਾਰ ਜਾਂਦੇ ਸ਼ੋਪਿੰਗ ਕਰਨ ਜਾਂਦੇ ਹਾਂ ਕੁਛ ਵੀ ਖਰੀਦਣਾ ਹੋਵੇ ਸਾਨੂੰ ਆਪਣੇ ਕੋਲ ਪੈਸੇ ਫੜਨ ਦੀ ਲੋੜ ਨਹੀਂ ਅਸੀਂ ਫੋਨਪੇ ਕਰ ਦਿੰਦੇ ਹਾਂ ਇਹ ਦੇ ਬਹੁਤ ਵੱਡੇ ਫ਼ਾਇਦੇ ਨੇ ਇਸ ਤਰ੍ਹਾਂ ਸਮਾਰਟ ਫੋਨ ਦੇ ਅਤੇ ਹੁਣ ਜਿਸ ਤਰ੍ਹਾਂ ਹੁਣ ਸਾਨੂੰ ਇਹਦੇ ਨੁਕਸਾਨ ਵੀ ਬਹੁਤ ਜ਼ਿਆਦਾ ਨੇ ਸਮਾਰਟ ਫੋਨ ਦੇ ਨੁਕਸਾਨ ਕੁਝ ਹੈਗੇ ਆ ਕਿ ਜਿਸ ਤਰ੍ਹਾਂ ਹੁਣ ਸਾਡਾ ਡਾਟਾ ਜਿਹੜਾ ਵਾ ਹੈਕਰ ਜਿਹੜੇ ਆ ਉਹ ਉਹ ਸਾਡੇ ਡਾਟੇ ਨੂੰ ਹੈਕ ਵੀ ਕਰ ਲੈਂਦੇ ਨੇ ਸਾਰੀ ਜਾਣਕਾਰੀ ਲੈ ਲੈਂਦੇ ਸਾਡੀ ਜਿਸ ਤਰ੍ਹਾਂ ਬੈਂਕ ਵਗੈਰਾ ਦੀ ਹੋਵੇ ਕੁਛ ਵੀ ਆ ਇਹ ਵੀ ਨੁਕਸਾਨ ਆ ਸਾਡਾ ਹੋਰ ਬੱਚਿਆਂ ਦੇ ਦਿਮਾਗ 'ਤੇ ਅੱਖਾਂ 'ਤੇ ਅਸਰ ਪੈਂਦਾ ਸਾਡੇ 'ਤੇ ਪੈਂਦਾ ਹੈ ਜ਼ਿਆਦਾ ਫੋਨ ਵੇਖਣ ਨਾਲ ਇੱਦਾਂ ਨਾਲ ਦਿਲ ਦੀਆਂ ਬਿਮਾਰੀਆਂ ਵੀ ਆਉਂਦੀਆਂ ਨੇ ਹੋਰ ਜਿਹੜੀਆਂ ਇਸਦੀਆਂ ਕਿਰਨਾਂ ਹੋਣ ਜਾਂ ਇਸਦੀਆਂ ਰੇਂਜ ਹੋਵੇ ਉਹ ਵੀ ਸਾਡੇ 'ਤੇ ਬਹੁਤ ਬੁਰਾ ਅਸਰ ਪਾਉਂਦੀਆਂ ਨੇ ਸਾਡੇ ਬੱਚੇ ਜਿਹੜੇ ਹੱਦ ਤੋਂ ਵੱਧ ਫੋਨ ਯੂਜ਼ ਕਰਦੇ ਨੇ ਗੇਮ ਖੇਡਦੇ ਜਾਂ ਕੁਛ ਵੀ ਆ ਉਹਨਾਂ 'ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ ਇਹਦਾ ਫਿਰ ਇੱਦਾਂ ਵਾ ਜੇ ਬੱਚੇ ਬੁਰਾ ਕੁਛ ਵੇਖਦੇ ਨੇ ਹੋਰ ਸਟੇਟਾਂ ਦਾ ਵੇਖਦੇ ਨੇ ਆਪਣਾ ਸੱਭਿਆਚਾਰ ਛੱਡ ਕੇ ਬੱਚੇ ਫੋਨ ਵਿੱਚ ਗਲਤ ਚੀਜ਼ਾਂ ਵੇਖ ਕੇ ਗਲਤ ਪਾਸੇ ਚਲਦੇ ਪਏ ਨੇ ਜਾਂਦੇ ਪਏ ਨੇ ਆਪਣੇ ਸੱਭਿਆਚਾਰ ਨੂੰ ਛੱਡ ਕੇ ਹੋਰ ਪਹਿਰਾਵੇ ਪਾਉਂਦੇ ਪਏ ਨੇ ਇਹਦੇ ਇਹ ਵੀ ਨੁਕਸਾਨ ਨੇ ਫੋਨ ਦੇ